ਬਾਈਕਿੰਗ ਦੁਆਰਾ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਬਾਈਕਸ ਉਪਰ ਵੱਖ ਵੱਖ ਤਰ੍ਹਾਂ ਦੇ ਕਲਾ ਚਿੱਤਰ ਬਣਾ ਕੇ ਅਤੇ ਉਥੋਂ ਦੇ ਆਮ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ਜਿਸ ਨਾਲ ਬਾਈਕ ਜਿੱਥੋਂ ਜਿੱਥੋਂ ਵੀ ਲੰਘੇਗੀ ਲੋਕਾਂ ਦੀ ਨਿਗਾਹ ਹਮੇਸ਼ਾ ਪੈਂਦੀ ਰਹੇਗੀ ਅਤੇ ਉਹ ਇਸ ਨਵੇਂ ਚਿੱਤਰਕਲਾ ਬਾਰੇ ਜ਼ਰੂਰ ਪੜ੍ਹਨ ਦੀ ਕੋਸ਼ਿਸ਼ ਕਰਨਗੇ